ਆਸਣ ਕੀ ਆ ਸਾਡੇ ਸਰੀਰ ਲਈ ਬਹੁਤ ਲਾਭਕਾਰੀ ਹਨ ਆਸਣ ਕਰਨ ਨਾਲ ਸਾਡਾ ਸਰੀਰ ਠੀਕ ਰਹਿੰਦਾ ਹੈਗਾ ਆਸਣ ਕਰਨ ਨਾਲ ਮਾਸਪੇਸ਼ੀਆਂ ਖੁੱਲਦੀਆਂ ਹਨ ਅਤੇ ਸਰੀਰ ਨੂੰ ਤਰੋ ਤਾਜ਼ਾ ਤਾਜ਼ਗੀ ਮਿਲਦੀ ਹੈ ਆਸਣ ਕਰਨ ਨਾਲ ਆਸਣ ਤਿੰਨ ਪ੍ਰਕਾਰ ਦੇ ਹੁੰਦੇ ਨੇ ਪਦਮ ਆਸਣ ਸ਼ੀਸ਼ ਆਸਣ ਭੁਝੰਗ ਆਸਣ ਇਨ੍ਹਾਂ ਨੂੰ ਕਰਨ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਠੀਕ ਹੋ ਜਾਂਦੀਆਂ ਨੇ ਅਤੇ ਜੋ ਪਦਾ ਪਦਮ ਆਸਣ ਇਹਦੇ ਨਾਲ ਸਰੀਰ ਨਾਲ ਲੱਤਾਂ ਬਾਹਾਂ ਸਭ ਠੀਕ ਰਹਿੰਦੀਆਂ ਨੇ ਗੀਆਂ ਸ਼ੀਸ਼ ਆਸਣ ਨਾਲ ਅਰਾਮ ਕਰਨ ਨਾਲ ਸਾਰਿਆਂ ਹੱਡਾਂ ਨੂੰ ਅਰਾਮ ਮਿਲਦਾ ਹੈਗਾ ਅੰਗਾਂ ਨੂੰ ਰੈਸਟ ਹੋ ਕੇ ਅੰਗ ਦੁਬਾਰੇ ਉਸ ਸਥਿਤੀ 'ਚ ਆ ਜਾਂਦੇ ਨੇ ਅਤੇ ਪਦਮ ਆਸਣ ਨਾਲ ਵੀ ਸਾਰੇ ਕੰਮ ਠੀਕ ਹੁੰਦੇ ਨੇ ਆਸਣ ਕਰਨ ਨਾਲ ਸਰੀਰ ਠੀਕ ਰਹਿੰਦਾ ਹੈਗਾ ਸਰੀਰ 'ਚ ਲਕ ਲਚਕਤਾ ਵਧੀ ਰਹਿੰਦੀ ਹੈ ਸਰੀਰ ਨੂੰ ਜਿਵੇਂ ਮਰਜ਼ੀ ਮੋੜ ਲਵੋ ਉਵੇਂ ਮੁੜ ਜਾਂਦਾ ਹੈ ਜੇ ਆਪਾਂ ਸਰੀਰ ਨੂੰ ਹਿਲਾਵਾਂਗੇ ਨਹੀਂ ਤਾਂ ਸਰੀਰ ਹਿੱਲਣ ਜੁੱਲਣ ਤੋਂ ਸਮਰਥ ਹੋ ਜਾਂਦਾ ਹੈ ਜੇ ਸਰੀਰ ਨੂੰ ਚਲਦਾ ਰੱਖਾਂਗੇ ਆਸਣ ਕਰਾਂਗੇ ਚਲਦੇ ਫਿਰਦੇ ਰਹਾਂਗੇ ਤਾਂ ਸਰੀਰ 'ਚ ਲਚਕਤਾ ਵਧੀ ਰਹਿੰਦੀ ਹੈ ਅਤੇ ਆਸਣ ਕਰਨ ਨਾਲ ਸਾਡੇ ਮਨ ਵੀ ਸ਼ਾਂਤ ਰਹਿੰਦਾ ਗਾ ਉਸਦੀਆਂ ਮਾਸਪੇਸ਼ੀਆਂ ਚਲਦੀਆਂ ਰਹਿੰਦੀਆਂ ਨੇ ਦਿਮਾਗ ਵੀ ਠੀਕ ਰਹਿੰਦਾ ਹੈਗਾ ਜੋ ਆਸਣ ਕਰਦਾ ਹੈ ਉਹ ਤੰਦਰੁਸਤ ਨੇ ਜੋ ਨਹੀਂ ਕਰਦੇ ਉਨ੍ਹਾਂ ਨੂੰ ਬਿਮਾਰੀਆਂ ਘੇਰ ਲੈਂਦੀਆਂ ਨੇ ਬਿਮਾਰੀਆਂ ਦੇ ਨਾਲ ਨਾਲ ਉਹ ਮਾਨਸਿਕ ਤੌਰ 'ਤੇ ਵੀ ਅਪਾਹਿਜ ਹੋ ਜਾਂਦੇ ਨੇ ਅਤੇ ਜੋ ਵੀ ਕੰਮ ਕਰਨਾ ਹੈ ਆਸਣ ਕਰੋ ਆਸਣ ਕਰਨ ਤੋਂ ਬਾਅਦ ਕਰੋ ਸਰੀਰ ਦੀ ਮਾਨਸਿਕਤਾ ਜ਼ਰੂਰੀ ਹੈ ਸਾਡੇ ਸਰੀਰ ਲਈ ਕੰਮ ਕਰਨਾ ਵੀ ਜਰੂਰੀ ਹੈ ਆਸਣ ਕਰਨਾ ਵੀ ਜ਼ਰੂਰੀ ਹੈ ਤੰਦਰੁਸਤ ਰਹਿਣਾ ਵੀ ਜ਼ਰੂਰੀ ਹੈ ਸਰੀਰਕ ਅਤੇ ਮਾਨਸਿਕ ਤੌਰ 'ਤੇ